ਸਾਡੇ ਘਰ ਦੇ ਕੋਲ ਤਾਂ ਕੋਈ ਸਮਾਰਕ ਧਾਰਮਿਕ ਸਥਾਨ ਕੋਲ ਤਾਂ ਨਹੀਂ ਹੈ ਥੋੜ੍ਹੀ ਜਿਹੀ ਦੂਰ ਹੈ ਜਿਵੇਂ ਕਿ ਹਰਿਮੰਦਰ ਸਾਹਿਬ ਹੋ ਗਿਆ ਗੋਲ ਦੁਰਗਿਆਨਾ ਮੰਦਰ ਹੋ ਗਿਆ ਰਾਮ ਤੀਰਥ ਹੋ ਗਿਆ ਸ ਸ਼ੀਤਲਾ ਹੋ ਰਾਮ ਰਾਮ ਤੀਰਥ ਹੋ ਗਿਆ ਫਿਰ ਵਾਹਗਾ ਬਾਰਡਰ ਹੋ ਗਿਆ ਕਈ ਇਹੋ ਜਿਹੀਆਂ ਚੀਜ਼ਾਂ ਨੇ ਪਰ ਮੌਸਮ ਤਾਂ ਚਲੋ ਹਰ ਮੌਸਮ ਹੀ ਘੁੰਮਣ ਵਾਲਾ ਹੁੰਦਾ ਹੈ ਪਰ ਗਰਮੀ ਦੇ ਵਿੱਚ ਜ਼ਰਾ ਘੁੰਮਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਹਰਿਮੰਦਰ ਸਾਹਿਬ ਦਾ ਵਿੱਚ ਜਾਣ ਦਾ ਇੱਕ ਅਲੱਗ ਹੀ ਨਜ਼ਾਰਾ ਹੈ ਉੱਥੇ ਚੌਵੀ ਘੰਟੇ ਲੰਗਰ ਗੁਰੂ ਜੀ ਦਾ ਲੰਗਰ ਚੌਵੀ ਘੰਟੇ ਚੱਲਦਾ ਹੈ ਉੱਥੇ ਦਿਨ ਰਾਤ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਲੋਕ ਬਾਹਰੋਂ ਆ ਕੇ ਵੀ ਸੇਵਾ ਬਹੁਤ ਕਰਦੇ ਨੇ ਉੱਥੇ ਚੌਵੀ ਘੰਟੇ ਕਦੀ ਵੀ ਖਾਣ ਦੀ ਮੁਸ਼ਕਲ ਨਹੀਂ ਆਉਂਦੀ ਨਾਲੇ ਹਰ ਇੰਨੀਆਂ ਕੁ ਸਰਾਵਾਂ ਅੰਮ੍ਰਿਤਸਰ ਦੇ ਵਿੱਚ ਬਣ ਚੁੱਕੀਆਂ ਹਨ ਕਿ ਕਿਸੇ ਵੀ ਯਾਤਰੀ ਨੂੰ ਬਾਹਰੋਂ ਆ ਕੇ ਰਹਿਣ ਦੀ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਰੇਟ ਵੀ ਕੋਈ ਖਾਸ ਜ਼ਿਆਦਾ ਨਹੀਂ ਹੁੰਦੇ ਲੋਕ ਰਾਮ ਤੀਰਥ ਵੀ ਜਾਂਦੇ ਨੇ ਪਰ ਸਰਦੀਆਂ ਦੇ ਵਿੱਚ ਦੁਨੀਆ ਬਹੁਤ ਆਉਂਦੀ ਹੈ ਦਸੰਬਰ ਦੇ ਵਿੱਚ ਕਈ ਤਾਂ ਜਨਵਰੀ ਦੇ ਪਹਿਲੀ ਜਨਵਰੀ ਦੇ ਆਪਣਾ ਨਵਾਂ ਸਾਲ ਹੀ ਗੁਰਦੁਆਰੇ ਮੰਦਰ ਤੀਰਥ ਸਥਾਨ ਦੇ ਵਿੱਚ ਆ ਕੇ ਮਨਾਉਂਦੇ ਨੇ ਉਹਨਾਂ ਨੂੰ ਬੜਾ ਚੰਗਾ ਲੱਗਦਾ ਹੈ ਕਿ ਅਸੀਂ ਸਾਲ ਦਾ ਪਹਿਲਾ ਦਿਨ ਰਾਮ ਮ ਦਰਬਾਰ ਸਾਹਿਬ ਆ ਕੇ ਹੀ ਮਨਾਈਏ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਉਹ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਨੇ ਅਤੇ ਐਨਾ ਕੁ ਲੰਗਰ ਐਨਾ ਕੁ ਭੋਜਨ ਉੱਥੇ ਦਿਨ ਰਾਤ ਬਣਦਾ ਹੈ ਸ਼ੀਤਲਾ ਮੰਦਰ ਵੀ ਹੋਰ ਦੁਰਗਿਆਨਾ ਮੰਦਰ ਵੀ ਬਹੁਤ ਜ਼ਿਆਦਾ ਮਸ਼ਹੂਰ ਨੇ ਇਹ ਤਾਂ ਅੰਮ੍ਰਿਤਸਰ 'ਚ ਇੱਕ ਮਸ਼ਹੂਰ ਨਾਮ ਦੇ ਵਿੱਚ ਆਉਂਦੇ ਨੇ